ਇੱਕ ਦਸੰਬਰ ਉੱਨੀ ਸੌ ਸੱਤਰ ਦੋ ਨਵੰਬਰ ਦੋ ਹਜ਼ਾਰ ਛੱਬੀ ਮਾਰਚ ਦੋ ਹਜ਼ਾਰ ਅਠਾਰ੍ਹਾਂ ਸਤਾਰ੍ਹਾਂ ਮਈ ਦੋ ਹਜ਼ਾਰ ਬਾਈ ਵੀਹ ਜੂਨ ਦੋ ਸੌ ਬਾਰ੍ਹਾਂ